ਹਾਂ ਆਵਾਜਾਈ ਦੀ ਘਾਟ ਜ਼ਰੂਰ ਤੀ ਇਹਦੇ ਵਿੱਚ ਜ਼ਰੂਰ ਫਰਕ ਪੈਂਦਾ ਸਿੱਖਿਆ ਨੌਕਰੀ ਅਤੇ ਸਿਹਤ ਨੂੰ ਕਿਉਂਕਿ ਸਮੇਂ ਨਾਲ ਸਿੱਖਿਆ ਨੂੰ ਜਾਣੇ ਵਾਸਤੇ ਤਾਂ ਚਲੋ ਆਸਾਨੀ ਹੈ ਪਰ ਨੌਕਰੀ ਥੋੜ੍ਹੀ ਜਿਹੀ ਕੰਪੀਟੀਸ਼ਨ ਜ਼ਿਆਦਾ ਹੈ ਪੜ੍ਹਾਈ ਕਿਉਂਕਿ ਹਰੇਕ ਬੰਦਾ ਅੱਜ ਕੱਲ੍ਹ ਪੜ੍ਹਿਆ ਲਿਖਿਆ ਏ ਬਾਕੀ ਸਿਹਤ ਸੰਭਾਲ ਨੇ ਵਾਸਤੇ ਸਾਨੂੰ ਥੋੜ੍ਹੀ ਜਿਹੀ ਮੁਸ਼ਕਿਲ ਆਉਂਦੀ ਹੈ ਕਿਉਂਕਿ ਐਬੂਲੈਂਸ ਦੀ ਪ੍ਰੋਬਲਮ ਥੋੜ੍ਹੀ ਥੋੜ੍ਹੀ ਹੈ ਕਿਤੇ ਨਾ ਕਿਤੇ ਆਉਂਦੀ ਹੈ ਲੇਕਿਨ ਥੋੜ੍ਹਾ ਟਾਇਮ ਲੱਗਦਾ ਏ ਉਹ ਜੋ ਕਿ ਬਹੁਤ ਬੜੀ ਇੱਕ ਪ੍ਰੋਬਲਮ ਹੈ ਇਸ ਨੂੰ ਸਰਕਾਰ ਨੂੰ ਇਸ ਵੱਲ ਧਿਆਨ ਵੀ ਦੇਣਾ ਚਾਹੀਦਾ ਹੈ ਬਾਕੀ ਪੜ੍ਹਾਈ ਦਾ ਲੈਵਲ ਥੋੜ੍ਹਾ ਹੈ ਉੱਪਰ ਹੋਇਆ ਹੈ ਜਿਸ ਵਿੱਚ ਸਿੱਖਿਆ ਖੇਤਰ ਨੇ ਬਹੁਤ ਵਧੀਆ ਤਰੱਕੀ ਕੀਤੀ ਹੈ ਬਾਕੀ ਮੋਹਾਲੀ ਜ਼ਿਲ੍ਹਾ ਇਸ ਵੇਲੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਉਪਲੱਬਧੀਆਂ ਛੂਹ ਰਿਹਾ ਹੈ